ਮੈਂ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਦਾ ਨਾਮ ਲੈ ਕੇ ਸ਼ੁਰੂ ਕਰਦਾ ਹਾਂ ਅਤੇ ਉਹਦੇ ਤੋਂ ਬਾਅਦ ਹੀ ਸਾਰੇ ਕੰਮ ਆਰੰਭ ਕਰਦਾ ਹਾਂ ਜਿਵੇਂ ਕਿ ਮੈਂ ਆਪਣਾ ਜੀਵਨ ਬਹੁਤ ਹੀ ਵਧੀਆ ਬਤੀਤ ਕਰਦਾ ਕਿਉਂਕਿ ਮੈਂ ਇੱਕ ਹਸਪਤਾਲ ਵਿੱਚ ਲੈਬ ਵਿੱਚ ਕੰਮ ਕਰਦਾ ਹਾਂ ਮੈਂ ਆਪਣੇ ਲੈਬ ਦੀ ਪੜ੍ਹਾਈ ਖਾਲਸਾ ਕੋਲਜ ਵਿੱਚ ਕੀਤੀ ਹੈ ਇਹ ਤਿੰਨ ਸਾਲ ਦਾ ਕੋਰਸ ਮੈਨੂੰ ਮੇਰੇ ਪਿਤਾ ਨੇ ਦੱਸਿਆ ਸੀ ਅਤੇ ਉਹਦੇ ਤੋਂ ਬਾਅਦ ਇਹ ਕੰਮ ਮੈਂ ਇੱਕ ਹਸਪਤਾਲ ਵਿੱਚ ਸਿੱਖਿਆ ਸ ਇੱਕ ਸਾਲ ਦਾ ਸਿੱਖਣ ਤੋਂ ਬਾਅਦ ਮੈਂ ਹੁਣ ਬਹੁਤ ਹੀ ਵਧੀਆ ਹਸਪਤਾਲ ਵਿੱਚ ਨੌਕਰੀ ਕਰ ਰਿਹਾ ਨੌਕਰੀ ਕਰਕੇ ਜਦੋਂ ਘਰ ਵਾਪਸ ਆਈ ਦਾ ਸ਼ਾਮ ਨੂੰ ਮੈਂ ਆਪਣਾ ਜੀਵਨ ਕੀਮਤੀ ਸਮਾਂ ਬਤੀਤ ਕਰਨ ਲਈ ਜਿੰਮ ਜਾਂਦਾ ਜਿੰਮ ਵਿੱਚ ਕਸਰਤ ਕਰੀ ਦੀ ਹੈ ਕਸ ਕਸਰਤ ਕਰਕੇ ਬਹੁਤ ਹੀ ਵਧੀਆ ਲੱਗਦਾ ਆਪਣਾ ਸਰੀਰ ਤੰਦਰੁਸਤ ਰਹਿੰਦੇ ਅਤੇ ਮਨ ਵੀ ਚੰਗਾ ਰਹਿੰਦੇ